ਸਤਿ ਸ਼੍ਰੀ ਅਕਾਲ ਸਰ ਦੇਸ ਰਾਜ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਸਾਡੇ ਪਠਾਨਕੋਟ ਦੇ ਵਿੱਚ ਬਹੁਤ ਵਧੀਆ ਹੀ ਸਕੂ ਸਕੂਲ ਸਕੂਲ ਅਤੇ ਕਾਲਜ ਨੇ ਸਾਡੇ ਪਠਾਨਕੋਟ ਦੇ ਵਿੱਚ ਐੱਸ ਐੱਸ ਐੱਮ ਡੀ ਕਾਲਜ ਰਮਨ ਚੋਪੜਾ ਕਾਲਜ ਆਈ ਟੀ ਆਈ ਕਾਲਜ ਅਤੇ ਗੌਰਮੈਂਟ ਕਾਲਜ ਅਤੇ ਰੀਮਾ ਮਾਡਲ ਸਕੂਲ ਹਾਈ ਸਕੂਲ ਸਾਡੇ ਪਠਾਨਕੋਟ ਦੇ ਵਿੱਚ ਬਹੁਤ ਹੀ ਵਧੀਆ ਸਕੂਲ ਅਤੇ ਕਾਲਜ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਬਹੁਤ ਹੀ ਵਧੀਆ ਪੜ੍ਹਾਈ ਮਿਲਦੀ ਹੈ ਇਹਨਾਂ ਸਕੂਲ ਅਤੇ ਕਾਲਜਾਂ ਵਿੱਚ ਬੱਚਿਆਂ ਨੂੰ ਵਧੀਆ ਸਿਖਲਾਈ ਮਿਲਦੀ ਹੈ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਗੀਤ ਵੀ ਬਹੁਤ ਪਸੰਦ ਲੱਗਦੇ ਹੈ ਸਾਡੇ ਪਠਾਨਕੋਟ ਦੇ ਵਿੱਚ ਵਧੀਆ ਕਾਲਜ

ਇਸ ਕਰਕੇ ਸਾਨੂੰ ਪਠਾਨਕੋਟ ਦੇ ਵਿੱਚ ਵਧੀਆ ਸੰਸਥਾ ਕਾਲਜਾਂ ਦੇ ਵਿੱਚ ਪ੍ਰਾਪਤ ਹੁੰਦੀ ਹੈ ਸਾਡੇ ਪਠਾਨਕੋਟ ਦੇ ਵਿੱਚ ਬਹੁਤ ਹੀ ਵਧੀਆ ਸਕੂਲ ਕਾਲਜ ਹੈ